ਹੈਲੋ ਹਾਂਜੀ ਅਸੀਂ ਹਰਪਾਲ ਟਿਊਸ਼ਨ ਕਲਾਸਿਸ ਤੋਂ ਬੋਲ ਰਹੇ ਸੀ ਹਾਂਜੀ ਤੁਸੀਂ ਫਤਿਹ ਦੀ ਮੰਮੀ ਬੋਲ ਰਹੇ ਹੋ ਅੱਛਾ ਜੀ ਹੋਰ ਕਿਦਾਂ ਠੀਕ ਹੈ ਜੀ ਹਾਂਜੀ ਉਹ ਨਾ ਫਤਿਹ ਬਾਰੇ ਗੱਲ ਕਰਨੀ ਸੀ ਜੀ ਫਤਿਹ ਨਾ ਡਾਂਸ ਤਾਂ ਵਧੀਆ ਸਿੱਖ ਰਿਹਾ ਹੈਗਾ ਵਧੀਆ ਉਹਦੀ ਪਰਫੋਰਮੈਂਸ ਆ ਪਰ ਥੋੜ੍ਹਾ ਜਿਹਾ ਨਾ ਸ਼ਰਾਰਤੀ ਜ਼ਿਆਦਾ ਹੈ ਉਹਦੀ ਸ਼ਰਾਰਤ ਕਰਕੇ ਨਾ ਬਾਕੀ ਸਾਰੀ ਕਲਾਸ ਨੂੰ ਵੀ ਥੋੜ੍ਹਾ ਡਿਸਟਰਬੈਂਸ ਹੁੰਦੀ ਹੈ ਹਾਂਜੀ ਹਾਂਜੀ ਪਰਫੋਰਮੈਂਸ ਤਾਂ ਉਹਦੀ ਬਹੁਤ ਵਧੀਆ ਜੀ ਪਰ ਥੋੜ੍ਹਾ ਜਿਹਾ ਨਾ ਸ਼ਰਾਰਤੀ ਜ਼ਿਆਦਾ ਹੋਣ ਕਰਕੇ ਮਤਲਬ ਇੱਕ ਜਗ੍ਹਾ ਟਿਕ ਕੇ ਤਾਂ ਬਿਲਕੁਲ ਨਹੀਂ ਬੈਠਦਾ ਹੈਗਾ ਬੋਲਦਾ ਵੀ ਥੋੜ੍ਹਾ ਜਿਹਾ ਜ਼ਿਆਦਾ ਹੈਗਾ ਅੱਛਾ ਅੱਛਾ ਅਤੇ ਤੁਹਾਡੇ ਘਰ 'ਚ ਵੀ ਕੋਈ ਉੱਚੀ ਬੋਲਦਾ ਇੰਨਾ ਉਹ ਸਾਰੀ ਮਤਲਬ ਕਲਾਸ 'ਚੋਂ ਇਕੱਲਾ ਹੀ ਹੈਗਾ ਜਿਹੜਾ ਨਾ ਤਾਂ ਟਿਕ ਕੇ ਬੈਠਦਾ ਸ਼ਰਾਰਤ ਵੀ ਬਹੁਤ ਜ਼ਿਆਦਾ ਕਰਦਾ ਹੈਗਾ ਅੱਛਾ ਅੱਛਾ ਠੀਕ ਹੈ ਨਹੀਂ ਤੁਸੀਂ ਨਾ ਵੈਸੇ ਫਤਿਹ ਨੂੰ ਸਮਝਾਇਓ ਫਤਿਹ ਨੂੰ ਜ਼ਰੂਰ ਸਮਝਾਇਓ ਕਿਉਂਕਿ ਨਾ ਡਿਸਪਲੇਨ ਦੇ ਵਿੱਚ ਰਿਹਾ ਕਰੇ ਘਰ ਵੀ ਉਹਨੂੰ ਡਿਸਪਲੇਨ ਦੇ ਵਿੱਚ ਰੱਖਿਆ ਕਰੋ ਨਾ ਨਾਲੇ ਇੱਕ ਜਗ੍ਹਾ ਟਿੱਕ ਕੇ ਬੈਠਣਾ ਜਿਵੇਂ ਇੱਕ ਗੂਡ ਮੈਨਰ ਹੁੰਦੇ ਹੈ ਨਾ ਬੱਚੇ ਨੂੰ ਉਹ ਚੀਜ਼ ਸਿਖਾਇਆ ਕਰੋ ਘਰ ਜੇ ਟਿੱਕ ਕੇ ਬੈਠੂਗਾ ਫਿਰ ਹੀ ਹੈ ਨਾ ਕਲਾਸ ਦੇ ਵਿੱਚ ਟਿਕ ਕੇ ਬੈਠੂਗਾ ਉਹ

ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਅਸੀਂ ਸਮਝਾਵਾਂਗੇ ਉਹਨੂੰ ਕੋਈ ਗੱਲ ਨਹੀਂ ਤੁਸੀਂ ਵੀ ਕੋਸ਼ਿਸ਼ ਕਰਿਓ ਅਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਬਸ ਉਹਨੂੰ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਜੀ